ਸਤਿ ਸ਼੍ਰੀ ਅਕਾਲ ਜੀ ਮੇਰੀ ਮਨਪਸੰਦ ਦਾ ਖੇਡ ਕ੍ਰਿਕਟ ਹੈ ਮੈਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਾਫੀ ਕ੍ਰਿਕਟ ਖੇਡਦਾ ਆਇਆ ਹਾਂ ਅਤੇ ਮੇਰੀ ਮਨਪਸੰਦ ਗੇਮ ਸੀ ਅਤੇ ਹੁਣ ਵੀ ਹੈ ਅਤੇ ਮੈਨੂੰ ਜਦੋਂ ਵੀ ਕੰਮ ਤੋਂ ਟਾਈਮ ਲੱਗਦਾ ਹੈ ਮੈਂ ਗੇਮ ਖੇਡਦਾ ਹਾਂ ਅਤੇ ਬਾਕੀ ਇਸ ਵਿੱਚ ਆਪਣੀ ਟੀਮ ਆਪਣੇ ਦੋਸਤਾਂ ਨਾਲ ਭਾਈਚਾਰਾ ਬਣਿਆ ਰਹਿੰਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਮੈਂ ਮੈਚ ਖੇਡਦਾ ਹਾਂ ਕ੍ਰਿਕਟ ਗੇਮ ਖੇਡਦਾ ਹਾਂ ਤਾਂ ਉਸ ਵਿੱਚ ਜਦੋਂ ਮੈਂ ਭੱਜ ਦੌੜ ਕਰਦਾ ਹਾਂ ਤਾਂ ਮੇਰੀ ਐਕਸਰਸਾਈਜ਼ ਦੀ ਐਕਸਰਸਾਈਜ਼ ਹੋ ਜਾਂਦੀ ਹੈ ਜਿਸ ਨਾਲ ਮੇਰਾ ਸਰੀਰ ਵੀ ਫਿੱਟ ਰਹਿੰਦਾ ਹੈ ਅਤੇ ਬਾਕੀ ਏਕਤਾ ਬਣੀ ਰਹਿੰਦੀ ਹੈ ਦੋਸਤਾਂ ਨਾਲ ਪ੍ਰੇਮ ਭਾਵ ਬਣਿਆ ਰਹਿੰਦਾ ਹੈ ਅਤੇ ਅੱਜ ਕੱਲ੍ਹ ਦਾ ਸਮੇਂ ਵਿੱਚ ਕਿਸੇ ਨੂੰ ਮਿਲਣ ਲਈ ਬਹੁਤ ਮਜਬੂਰੀ 'ਚ ਟਾਈਮ ਕੱਢਣਾ ਪੈਂਦਾ ਹੈ ਪਰ ਜਦੋਂ ਗੇਮ ਦੀ ਵਾਰੀ ਆਉਂਦੀ ਹੈ ਤਾਂ ਹਰ ਦੋਸਤ ਸਮੇਂ ਅਨੁਸਾਰ ਪੁੱਜ ਜਾਂਦਾ ਹੈ ਅਤੇ ਅਸੀਂ ਹਾਸੀ ਮਜ਼ਾਕ ਵੀ ਕਰਦੇ ਹਾਂ ਗੇਮ ਖੇਡਦੇ ਹਾਂ ਰੱਜ ਕੇ ਅਤੇ ਬਹੁਤ ਹੀ ਲੋਕਪ੍ਰਿਯ ਗੇਮ ਹੈ ਹੁਣ ਤਾਂ ਇਹ ਟੀ ਵੀ ਵਗੈਰਾ ਫੋਨ ਵਗੈਰਾ 'ਤੇ ਵੀ ਆਉਣ ਲੱਗ ਪਈ ਹੈ ਲਾਈਵ ਨਹੀਂ ਤਾਂ ਪਹਿਲਾਂ ਪਿੰਡਾਂ ਵਿੱਚ ਸਕੂਲ ਵਿੱਚ ਜਾ ਕੇ ਜਾਂ ਕਿਤੇ ਹੋਰ ਜਾ ਕੇ ਗਰਾਉਂਡ ਲੱਭਣਾ ਪੈਂਦਾ ਕੋਈ ਸਾਫ ਜਗ੍ਹਾ ਲੱਭ ਕੇ ਗੇਮ ਖੇਡਣੀ ਪੈਂਦੀ ਸੀ ਅੱਜ ਕੱਲ੍ਹ ਹਰ ਸਕੂਲ 'ਚ ਹਰ ਪਿੰਡ 'ਚ ਮੈਦਾਨ ਬਣਿਆ ਹੋਇਆ ਹੈ ਇਸ ਲਈ ਕ੍ਰਿਕੇਟ ਮੇਰੀ ਮਨਪਸੰਦ ਗੇਮ ਹੈ